ਪੰਜਾਬ ਲੋਕ ਵਿੱਚ ਸੱਭਿਆਚਾਰ ਮੇਲੇ ਵੀ ਕਰਵਾਏ ਜਾਂਦੇ ਹਨ ਕਿ ਜਿਵੇਂ ਕਿ ਪੰਜਾਬ ਦਾ ਬਹੁਤ ਹੀ ਸੱਭਿਆਚਾਰ ਅਮੀਰ ਹੈ ਅਤੇ ਇੱਥੇ ਮੇਲੇ ਕਰਵਾਏ ਜਾਂਦੇ ਹਨ ਅਤੇ ਭੰਗੜਾ ਜਿਵੇਂ ਕਿ ਪੰਜਾਬ ਲੋਕ ਦਾ ਭੰਗੜਾ ਗਿੱਧਾ ਨਾਚ ਲੋਕ ਬੋਲੀਆਂ ਕਵਾਲੀਆਂ ਵੀ ਕਰਵਾਈਆਂ ਜਾਂਦੀਆਂ ਜਿਵੇਂ ਕਿ ਕੁੜੀਆਂ ਬੋਲੀਆਂ ਪਾਉਂਦੇ ਆ ਅਤੇ ਮੁੰਡੇ ਵੀ ਭੰਗੜਾ ਪਾਉਂਦੇ ਆ ਬਹੁਤ ਹੀ ਸ਼ਾਨਦਾਰ ਭੰਗੜਾ ਪਾਉਂਦੇ ਅਤੇ ਕਵਾਲੀਆਂ ਗਾਉਣ ਵਾਲੇ ਕਵਾਲੀਆਂ ਗਾਉਂਦੇ ਆ ਅਤੇ ਮੇਲਿਆਂ ਵਿੱਚ ਸਿੰਗਰ ਵੀ ਬੁਲਾਏ ਜਾਂਦੇ ਹਨ ਜਿਵੇਂ ਕਿ ਗੁਰਦਾਸ ਮਾਨ ਜੀ ਦਾ ਸੌਂਗ ਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਜਿਵੇਂ ਕਿ ਗੁਰਦਾਸ ਮਾਨ ਨੇ ਦੱਸਿਆ ਕਿ ਆਪਣੇ ਹੱਕ ਬਾਰੇ ਬਈ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਜਿਵੇਂ ਕਿ ਬੱਬੂ ਮਾਨ ਬੱਬੂ ਮਾਨ ਜੀ ਨੇ ਦੱਸਿਆ ਕਿ ਕਿਸਾਨ ਬਾਰੇ ਇਹ ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ ਸਾਰੀ ਉਮਰ ਦਾ ਇਹੋ ਸੁੱਕਾ ਪੌਂਡਾ ਵਾਹੁਣਾ ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ ਅਤੇ ਜਿਵੇਂ ਕਿ ਪੰਜਾਬ ਵਿੱਚ ਬਹੁਤ ਹੀ ਸ਼ਾਨਦਾਰ ਮੇਲੇ ਕਰਵਾਏ ਜਾਂਦੇ ਹਨ ਅਤੇ ਇਸ ਕਰਕੇ ਸਿੰਗਰ ਵੀ ਬਹੁਤ ਸਾਰੇ ਬੁਲਾਏ ਜਾਂਦੇ ਹਨ ਜਿਵੇਂ ਕਿ ਕਰਨ ਔਜਲਾ ਹੋ ਗਿਆ ਬੱਬੂ ਮਾਨ ਸਿੱਧੂ ਮੂਸੇਆਲ਼ਾ ਭਾਰਤ ਦਾ ਸਭ ਤੋਂ ਚੋਟੀ ਦਾ ਸਿੰਗਰ ਸੀ ਜਿਵੇਂ ਕਿ ਉਸ ਦੀ ਹੱਤਿਆ ਕਰ ਦਿੱਤੀ ਗੋਲੀਆਂ ਮਾਰ ਕੇ ਫਿਰ ਵੀ ਹਾਲੇ ਵੀ ਉਸਦੇ ਗਾਉਣੇ ਆਉਂਦੇ ਪਏ ਜਿਵੇਂ ਕਿ ਗਾਉਣ ਆਇਆ ਦੀਵਾਲੀ 'ਤੇ